ਵੈਸੇ ਤਾਂ ਮਾਰਕੀਟ 'ਚ ਬਹੁਤ ਕੰਪਨੀਆਂ ਨੇ ਪਰ ਅੱਜ ਮੈਂ ਜਿਹੜੀ ਕੰਪਨੀ ਬਾਰੇ ਆਪਣਾ ਰਿਵਿਊ ਸ਼ੇਅਰ ਕਰ ਰਿਹਾ ਹਾਂ ਉਹ ਹੈਗੀ ਹੈ ਨਾਇਕੀ ਕੰਪਨੀ ਅਕਸਰ ਮੇਰਾ ਕੰਮ ਕੰਸਟਰਕਸ਼ਨ ਦਾ ਰਹਿੰਦਾ ਹੈ ਅਤੇ ਮੇਰੀ ਭੱਜ ਦੌੜ ਬਹੁਤ ਜਿਆਦਾ ਰਹਿੰਦਾ ਹੈ ਅਤੇ ਮੈਨੂੰ ਇੱਕ ਸਹੀ ਬ੍ਰੈਂਡ ਦੇ ਸਹੀ ਸ਼ੂਜ਼ ਚਾਹੀਦੇ ਸੀ ਜਿਸ ਨਾਲ ਮੇਰੇ ਪੈਰਾਂ ਦਾ ਦਰਦ ਖਤਮ ਹੋ ਸਕੇ ਅਤੇ ਮੇਰੇ ਕਿਸੀ ਦੋਸਤ ਨੇ ਮੈਨੂੰ ਨਾਇਕੀ ਦੇ ਈਜ਼ੀ ਮੋਡਲ ਦੇ ਸ਼ੂਜ਼ ਲੈਣ ਲਈ ਕਿਹਾ ਅਤੇ ਮੈਂ ਉਹ ਸ਼ੂਜ਼ ਲਏ ਉਸ ਤੋਂ ਬਾਅਦ ਮੇਰੇ ਪੈਰਾਂ ਦੇ ਵਿੱਚ ਦਰਦ ਖਤਮ ਹੋ ਗਿਆ ਕਿਉਂਕਿ ਮੇਰਾ ਅਕਸਰ ਭੱਜ ਦੌੜ ਦਾ ਕੰਮ ਰਹਿੰਦਾ ਹੈ ਕਿਉਂਕਿ ਉਹ ਸ਼ੂਜ਼ ਦੇ ਵਿੱਚ ਸੋਲ ਬਹੁਤ ਹੀ ਵਧੀਆ ਸੀ ਅਤੇ ਬਹੁਤ ਹੀ ਹੀ ਆਸਾਨੀ ਨਾਲ ਮੇਰਾ ਪੈਰ ਉਹਦੇ ਵਿੱਚ ਲੰਬੇ ਸਮੇਂ ਤੱਕ ਟਿੱਕ ਜਾਂਦਾ ਸੀ ਅਤੇ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਕੋਈ ਪਾਇਆ ਹੀ ਨਹੀਂ ਹੋਇਆ ਪੈਰਾਂ ਵਿੱਚ ਕੁਝ 'ਤੇ ਉਹ ਬਹੁਤ ਆਪਣਾ ਮੈਨੂੰ ਉਹਦੇ ਨਾਲ ਪਾ ਕੇ ਬਹੁਤ ਕੰਫਰਟੇਬਲ ਮਹਿਸੂਸ ਹੁੰਦਾ ਸੀ ਅਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਕੰਮ ਕਰ ਸਕਦਾ ਸੀ ਅਤੇ ਇਸ ਦੇ ਕਾਰਨ ਨਾਇਕੀ ਦੇ ਇਸ ਸ਼ੂਜ਼ ਦੇ ਪ੍ਰੋਡਕਟ ਦੇ ਕਾਰਨ ਮੇਰੇ ਕੰਮ ਕਰਨ ਦਿਆ ਸਮਾਂ ਹੋਰ ਵੀ ਵੱਧ ਗਿਆ ਅਤੇ ਮੈਂ ਘੱਟ ਥੱਕਣ ਲੱਗ ਗਿਆ